ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਨੇ ਹਾਂਜੀ ਵਧੀਆ ਵਧੀਆ ਤੁਸੀਂ ਹੋਰ ਕੀ ਕਰਦੇ ਹੁੰਦੇ ਜੀ ਅੱਜ ਕੱਲ੍ਹ ਹਾਂਜੀ ਹਾਂਜੀ ਲਿਖਾਈ ਕਰਦੇ ਜੀ ਸਾਡਾ ਤਾਂ ਲਿਖਾਈ ਨਾਲ ਬਹੁਤ ਪੁਰਾਣਾ ਰਿਸ਼ਤਾ ਜੀ ਲਿਖਾਈ ਲਿਖਾਈ ਤਾਂ ਵੀਰੇ ਜੀ ਇੱਧਰ ਵੇਖੋ ਲਿਖਾਈ ਤਾਂ ਕਈ ਵਾਰੀ ਮੁੱਦਿਆਂ 'ਤੇ ਹਰ ਇੱਕ ਮੁੱਦਿਆਂ 'ਤੇ ਕਰਦੇ ਹਾਂ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਆਪਾਂ ਜੀ ਆਪਾਂ ਲਿਖਾਈ ਨੂੰ ਪੇਪਰ 'ਤੇ ਉਭਾਰਦੇ ਹਾਂ ਜੀ ਫਿਰ ਉਹਨੂੰ ਵਿਗਿਆਨੀ ਤੌਰ 'ਤੇ ਢੰਗ ਨਾਲ ਲਿਖ ਕੇ ਵੇਣੇ ਹਾਂ ਵਿਗਿਆਨਿਕ ਜ਼ਿਆਦਾਤਰ ਤਾਂ ਜੀ ਵਿਸ਼ੇ ਆਪਾਂ ਅੱਜ ਕੱਲ੍ਹ ਸਮਾਜਿਕ ਮੁੱਦੇ ਜ਼ਿਆਦਾ ਚੱਲ ਰਹੇ ਆ ਜਿਵੇਂ ਕਿਸਾਨਾਂ ਨੂੰ ਲੈ ਕੇ ਪਾਣੀ ਨੂੰ ਲੈ ਕੇ ਆਹ ਪ੍ਰਦੂਸ਼ਣ ਨੂੰ ਲੈ ਕੇ ਵਾਤਾਵਰਨ ਨੂੰ ਲੈ ਕੇ ਜ਼ਿਆਦਾਤਰ ਇਹ ਮੁੱਦਿਆਂ ਦੇ ਆਪਾਂ ਚਰਚਾ ਕਰੀ ਦੀ ਹੈ ਕੀ ਜੀਏ ਜੋ ਅੱਜ ਕੱਲ੍ਹ ਦੇ ਵਿੱਚ ਮੁਸ਼ਕਲ ਆਉਂਦੀ ਹੈ ਜੀ ਕਈ ਵਾਰੀ ਸ਼ਬਦਾਂ ਦੀ ਘਾਟ ਪੈ ਜਾਂਦੀ ਹੈ ਅਤੇ ਕਈ ਵਾਰੀ ਆਪਣੇ ਦਿਮਾਗ ਦਿਮਾਗ ਵਿੱਚ ਕਈ ਵਾਰੀ ਕੋਈ ਅੱਖਰ ਨਹੀਂ ਆਉਂਦਾ ਇਸ ਕਰਕੇ ਥੋੜ੍ਹੇ ਮੁਸ਼ਕਲ ਹੋਣੀ ਹੋ ਜਾਂਦੀ ਹੈ ਪਰ ਆਪਣੇ ਆਪ ਨੂੰ ਥੋੜ੍ਹਾ ਕਰ ਲਈ ਦਾ ਲਿਖਾਈ ਲਈ ਸਭ ਤੋਂ ਜ਼ਰੂਰੀ ਤਾਂ ਇਹ ਹੈ ਕਿ ਆਪਣੇ ਆਪ ਨੂੰ ਸ਼ਾਂਤ ਰੱਖਣਾ ਅਤੇ ਧੀਰਜ ਨਾਲ ਕੰਮ ਕਰਨਾ ਇਹ ਦੋਵੇਂ ਗੁਣ ਬਹੁਤ ਚੰਗੀ ਲਿਖਾਈ ਕਰਦੇ ਆ ਜੀ ਇਹ ਮੈਂ ਤਾਂ ਜੀ ਸਮਾਜ ਦੇ ਮੁੱਦਿਆਂ ਨੂੰ ਚੁਣਦਾ ਹਾਂਜੀ ਇਸ ਤੋਂ ਬਾਅਦ ਆਪਾਂ ਕੋਈ ਹੋਰ ਅਜੇ ਵਿਸ਼ਾ ਨਹੀਂ ਆਪਾਂ ਚੁਣਿਆ ਜੀ ਮੈਂ ਆਪਣੇ ਲਿਖਾਈ ਦੇ ਵਿਸ਼ੇ ਨੂੰ ਵਿਕਸਿਤ ਕਰਨ ਲਈ ਆਪਣੇ ਤਰੀਕਿਆਂ ਦੀ ਵਰਤੋਂ ਕਰਦਾ ਜੀ ਜਿਵੇਂ ਮੈਂ ਕਿਤਾਬਾਂ ਪੜ੍ਹਨਾ ਲੋਕਾਂ ਨਾਲ ਗੱਲਾਂ ਗੁੱਲਾਂ ਕਰਕੇ ਆਪਣੇ ਵਿਚਾਰਾਂ ਨੂੰ ਲਿਖਦਾ ਹਾਂ ਆਲੇ ਦੁਆਲੇ ਨੂੰ ਵੇਖਦਾ ਹਾਂ ਇਨਵਾਇਰਮੈਂਟ ਵੇਖਦਾ ਹਾਂ ਕਿ ਆਲੇ ਦੁਆਲੇ ਵਿੱਚ ਮੇਰੇ ਕੀ ਹੋ ਰਿਹਾ ਹੈ ਹਾਂਜੀ ਹਾਂਜੀ ਜਿਵੇਂ ਹੁਣ ਮੇਰੇ ਮੇਰੇ ਸਾਹਮਣੇ ਕੋਈ ਕਿਸਾਨ ਕੰਮ ਕਰ ਰਿਹਾ ਤਾਂ ਮੈਂ ਉਹਨੂੰ ਦੇਖ ਕੇ ਮੈਂ ਚਾਰ ਲਾਈਨਾਂ ਲਿਖ ਸਕਦਾ ਕਿ ਕਿਸਾਨ ਸਾਹਮਣੇ ਕੰਮ ਕਰ ਰਿਹਾ ਹੱਲ ਵਾਹ ਰਿਹਾ ਖੇਤਾਂ ਨੂੰ ਪਾਣੀ ਦੇ ਰਿਹਾ ਸਿੰਚਾਈ ਬਿਜਾਈ ਕਰ ਰਿਹਾ ਪ੍ਰਗਟ ਤਾਂ ਚਲੋ ਤੁਸੀਂ ਲਾ ਹੀ ਸਕਦੇ ਹੋ ਬਾਕੀ ਆਪਣੇ ਆਪ ਨੂੰ ਵੀ ਕੋਸ਼ਿਸ਼ ਕਰਨੀ ਪੈਂਦੀ ਕਿ ਕਿਵੇਂ ਸ਼ਬਦ ਨੂੰ ਜੋੜਨਾ ਕਿਵੇਂ ਸ਼ਬਦ ਨੂੰ ਤੋੜਨਾ ਕਿਵੇਂ ਹੁੰਦਾ ਵਿ ਉਸ ਨੂੰ ਵਿਕਸਿਤ ਕਰਨਾ ਕਿਵੇਂ ਹਾਂਜੀ ਹਾਂਜੀ ਹਾਂਜੀ ਹਾਂਜੀ ਜਿਵੇਂ ਕਿ ਮਤਲਬ ਚੰਗਾ ਕਰਨ ਲਈ ਤਰੀਕਿਆਂ ਦੀ ਵਰਤੋਂ ਕਰਦਾ ਜਿਵੇਂ ਨੋਟ ਮੈਂ ਜਿਵੇਂ ਇਮੈਜਿਨ ਸਾਹਮਣੇ ਮੇਰੇ ਕੋਈ ਜਿਵੇਂ ਤੁਸੀਂ ਕੰਮ ਕਰ ਰਹੇ ਹੋ ਜਿਵੇਂ ਕੋਈ ਵਿਅਕਤੀਗਤ ਕਰ ਰਿਹਾ ਮੈਂ ਉਸ ਉਸ ਬਾਰੇ ਆਪਣੇ ਦਿਮਾਗ ਵਿੱਚ ਇੱਕ ਇਮੇਜ ਬਣਾ ਲਵਾਂਗਾ ਉਸ ਦਾ ਇੱਕ ਮੂਵੀ ਬਣਾ ਲਵਾਂਗਾ ਉਸ ਬਾਰੇ ਲਿਖਣ ਬਾਰੇ ਅਤੇ ਉਹ ਇਵੇਂ ਕੰਮ ਕਰ ਉਸ ਨੂੰ ਫਿਰ ਮੈਂ ਇੱਕ ਕਿਤਾਬ ਦੇ ਉੱਤੇ ਉਭਾਰ ਲੈਂਦਾ ਉਭਾਰ ਕੇ ਉਸ ਨੂੰ ਮੈਂ ਜਾਂ ਕੰਪਿਊਟਰ 'ਤੇ ਜਾਂ ਮੋਬਾਈਲ ਵਿੱਚ ਸੇਵ ਕਰਕੇ ਰੱਖ ਲੈਂਦਾ ਕਿ ਆਉਣ ਵਾਲੇ ਟਾਈਮ ਵਿੱਚ ਮੇਰੇ ਉਹ ਕੰਮ ਆ ਸਕੇ ਹਾਂਜੀ ਹਾਂਜੀ ਤੁਸੀਂ ਤੁਸੀਂ ਵੀ ਲਿਖਾਈ ਕਰਦੇ ਹੋ ਨਾ ਪ੍ਰਕਾਸ਼ਿਤ ਤਾਂ ਵੇਖੋ ਜੀ ਕਿਤਾਬਾਂ ਦੇ ਇੱਦਾਂ ਹੈ ਹੁੰਦੀ ਹੈ ਜ਼ਿਆਦਾਤਰ ਤਾਂ ਬਾਕੀ ਆਪਣੇ ਵਿਸ਼ੇ ਨੂੰ ਵਿਕਸਿਤ ਕਰਨ ਲਈ ਮੈਂ ਕਈ ਤਰੀਕਿਆਂ ਦੀ ਵਰਤੋਂ ਕਰਦਾ ਮੈਂ ਕਿਤਾਬਾਂ ਪੜ੍ਹਦਾ ਜੀ ਇਸ ਦੇ ਨਾਲ ਮੈਂ ਨੋਟਬੁਕ 'ਤੇ ਲਿਖ ਕੇ ਰੱਖ ਲੈਂਦਾ ਅਤੇ ਉਹਨਾਂ ਨੂੰ ਪ੍ਰਕਾਸ਼ਿਤ ਕਰਨ ਲਈ ਮੈਂ ਆਪਣੀ ਨੋ ਗਿਆਨ ਨੂੰ ਵਧਾਉਣ ਲਈ ਅਖ਼ਬਾਰਾਂ ਮੈਗਜ਼ੀਨਾਂ ਕਿਤਾਬਾਂ ਨੂੰ ਪ੍ਰਕਾਸ਼ਿਤ ਕਰਦਾ ਜੀ ਜਿੱਥੋਂ ਵੀ ਮੈਨੂੰ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੋਵੇ ਮੈਂ ਲੋਕਾਂ ਨਾਲ ਗੱਲਾਂ ਕਰਦਾ ਅਖ਼ਬਾਰਾਂ ਪੜ੍ਹਦਾ ਜੋ ਵੀ ਅੱਜ ਦੇ ਅਤੇ ਜਾਂ ਮੈਂ ਅਖ਼ਬਾਰਾਂ ਦੇ ਵਿੱਚ ਆਪਣੇ ਲਿਖਣ ਵਾਲੀਆਂ ਕਵਿਤਾਵਾਂ ਵੀ ਬਹੁਤ ਛਾਪੀਆਂ ਨੇ ਜਗ ਬਾਣੀ ਨਿਊਜ਼ ਦੇ ਵਿੱਚ ਤੁਸੀਂ ਅਖ਼ਬਾਰ ਪੜ੍ਹਦੇ ਹੋ ਕਦੀ ਮੇਰੀ ਵੇਖਿਆ ਹੋਵੇਗੀ ਤੁਸੀਂ ਮੇਰੀ ਕਹਾਣੀ ਜਾਂ ਕਿੱਸਾ ਕੋਈ ਤੁਸੀਂ ਵੇਖਿਆ ਕਦੇ ਹਾਂਜੀ ਹਾਂਜੀ ਉਹ ਮੇਰੀ ਲਿਖੀ ਹਾਂਜੀ ਹਾਂਜੀ ਪਰ ਹੁਣ ਮੈਂ ਥੋੜ੍ਹਾ ਜਿਹਾ ਆਪਣਾ ਲਿਖਤ ਘੱਟ ਕਰ ਦਿੱਤੀ ਤੁਸੀਂ ਉਹ ਜਿਵੇਂ ਕਹਿੰਦੇ ਨਾ ਕਿ ਹਾਂਜੀ ਹਾਂਜੀ ਹਾਂਜੀ ਹਾਂਜੀ ਉਹੀ ਗੱਲ ਹੈ ਕਿ ਜਿਵੇਂ ਜਿਵੇਂ ਸਮਾਂ ਗੁਜ਼ਰ ਰਿਹਾ ਬੰਦੇ ਲੰਘ ਰਹੇ ਨੇ ਨਵੇਂ ਆਈ ਜਾ ਰਹੇ ਨੇ ਨਵੇਂ ਤੋਂ ਨਵੇਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਕਿੰਨੇ ਗਾਣੇ ਚੱਲ ਰਹੇ ਨੇ ਉਹਦੇ ਵਿੱਚ ਕੋਈ ਨਵੇਂ ਤੋਂ ਨਵਾਂ ਜਿਵੇਂ ਸਤਿੰਦਰ ਸਰਤਾਜ ਹੋ ਚੁੱਕਿਆ ਗੁਰਦਾਸ ਮਾਨ ਹੋ ਚੁੱਕਿਆ ਨਵੇਂ ਇਹ ਤਾਂ ਸਭ ਪੁਰਾਣੇ ਹੋ ਚੁੱਕੇ ਨਾ ਹੁਣ ਤੋਂ ਨਵੇਂ ਨਵੇਂ ਕਲਾਕਾਰ ਆਏ ਜਾ ਰਹੇ ਨੇ ਕੋਈ ਵੀ ਪੰਜਾਬ ਦੇ ਮੁੱਦੇ ਬਾਰੇ ਨਹੀਂ ਗੱਲ ਕਰਦਾ ਹਮੇਸ਼ਾ ਪਰ ਧੰਨਵਾਦ ਜੀ ਧੰਨਵਾਦ